ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਤੁਸੀਂ ਵਣ ਵਿਭਾਗ ਤੋਂ ਬੋਲ ਰਹੇ ਹੋ ਹਾਂਜੀ ਮੈਂ ਤੁਹਾਨੂੰ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਵੀ ਹੁਣ ਸੀਜ਼ਨ ਆ ਰਿਹਾ ਸਰਦੀਆਂ ਦਾ ਅਤੇ ਤੁਸੀਂ ਇਸ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ ਵੀ ਹੁਣ ਦੇ ਮੌਸਮ ਦੇ ਵਿੱਚ ਕਿੱਦਾਂ ਸਾਨੂੰ ਫੁੱਲ ਬੂਟੀਆਂ ਲਾਉਣੀ ਚਾਹੀਦੀਆਂ ਜਾਂ ਕਿਹੜੇ ਦਰਖ਼ਤ ਲਗਾਉਣੇ ਚਾਹੀਦੇ ਆ ਜੋ ਕਿ ਸਹੀ ਹੋਣ ਵਿਭਾਗ ਵਾਸਤੇ ਵੀ ਹਾਂਜੀ ਹਾਂਜੀ ਅਸੀਂ ਤਾਂ ਜੀ ਲਗਾਉਦੇ ਹਾਂ ਜੀ ਹਾਂਜੀ ਉਹ ਤਾਂ ਸਹੀ ਹੈ ਜੀ ਪਰ ਇਹਨਾਂ ਦੀ ਰਖਵਾਲੀ ਕਿਵੇਂ ਕਰਨੀ ਦੇਖਭਾਲ ਕਿਵੇਂ ਕਰਨੀ ਇਹਨਾਂ ਦੀ ਇਹਦੇ ਬਾਰੇ ਤੁਸੀਂ ਮੈਨੂੰ ਥੋੜ੍ਹੀ ਜਾਣਕਾਰੀ ਦੇ ਦਿਓਂਗੇ ਤਾਂ ਅਤੇ ਜੀ ਤੁਹਾਡੇ ਇਹ ਸੈਮੀਨਾਰ ਕਦੋਂ ਕਦੋਂ ਲੱਗਦੇ ਹੁੰਦੇ ਆ ਹਾਂਜੀ ਹਾਂਜੀ ਅਸੀਂ ਤਾਂ ਜੀ ਬਥੇਰੇ ਬਥੇਰਾ ਕਰੀ ਦਾ ਬਥੇਰੇ ਲਾਏ ਵੇ ਜਿੰਨਾ ਸਾਡੇ ਤੋਂ ਹੋ ਸਕੇ ਲੇਕਿਨ ਹੁਣ ਹਵਾ ਹੀ ਇੰਨੀ ਪ੍ਰਦੂਸ਼ਿਤ ਹੋਈ ਪਈ ਆ ਪੰਜਾਬ 'ਚ ਪਰਾਲੀਆਂ ਜਲਾ ਜਲਾ ਕੇ ਇੰਨਾ ਬੁਰਾ ਹਾਲ ਕੀਤਾ ਹੋਇਆ ਕਿ ਅਸੀਂ ਕੀ ਕਹੀਏ ਸਾਨੂੰ ਸਾਹ ਲੈਣ ਆ ਵੀ ਔਖਾ ਹੋਇਆ ਪਿਆ ਹਾਂਜੀ ਹਾਂਜੀ ਹਾਂਜੀ ਅਸੀਂ ਆਵਾਂਗੇ ਕੱਲ੍ਹ ਅਤੇ ਤੁਸੀਂ ਸਾਨੂੰ ਸਾਰਾ ਕੁਝ ਦੱਸ ਦਿਓ ਓਕੇ ਜੀ ਧੰਨਵਾਦ ਜੀ ਧੰਨਵਾਦ